ਸਕੂਲ ਤੋਂ ਬਾਅਦ ਸ਼ਾਮ ਦੀ ਟਿਊਸ਼ਨ ਜਾਂ ਪ੍ਰਾਈਵੇਟ ਕਲਾਸ ਬਾਰੇ ਮੇਰਾ ਇਹ ਵਿਚਾਰ ਹੈ ਕਿ ਇਸਦੀ ਸਾਨੂੰ ਜ਼ਰੂਰਤ ਹੀ ਨਹੀਂ ਹੈ ਜੇ ਆਪਾਂ ਪੂਰੀ ਜ਼ਿੰਮੇਵਾਰੀ ਅਤੇ ਲਗਨ ਨਾਲ ਸਕੂਲ ਵਿੱਚ ਹੀ ਸਭ ਸਮਝ ਕੇ ਪੜ੍ਹ ਲਈਏ ਅਤੇ ਆਪਣੀ ਜ਼ਿੰਮੇਵਾਰੀ ਨਾਲ ਘਰ ਦਾ ਸਾਰਾ ਕੰਮ ਕਰਕੇ ਪੜ੍ਹਾਈ ਨੂੰ ਤਰਜੀਹ ਦਈਏ ਤਾਂ ਆਪਾਂ ਬਿਨਾਂ ਕਿਸੇ ਪ੍ਰਾਈਵੇਟ ਟਿਊਸ਼ਨ ਤੋਂ ਵੀ ਵਧੀਆ ਅੰਕ ਹਾਸਲ ਕਰ ਸਕਦੇ ਹਾਂ ਮੇਰੇ ਹਿਸਾਬ ਨਾਲ ਜੇ ਤੁਸੀਂ ਜ ਆਪਣੀ ਜ਼ਿੰਮੇਵਾਰੀ ਨਾਲ ਪੜ੍ਹ ਰਹੇ ਹੋ ਤਾਂ ਤੁਹਾਨੂੰ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਸਿਰਫ਼ ਤੁਹਾਡੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੈ ਇਹ ਸਮਾਂ ਤੁਸੀਂ ਕਿਸੇ ਵਧੀਆ ਚੀਜ਼ ਵਿੱਚ ਲਾਸ ਲਗਾ ਸਕਦੇ ਹੋ ਜਿਵੇਂ ਕਿ ਸਾਨੂੰ ਕੋਈ ਖੇਡ ਖੇਡਣਾ ਪਸੰਦ ਹੈ ਤਾਂ ਤੁਸੀਂ ਉਹ ਖੇਡ ਸਕਦੇ ਹੋ ਜਾਂ ਤੁਸੀਂ ਆਪਣੇ ਘਰ ਦਾ ਕੋਈ ਕੰਮ ਕਰਾ ਸਕਦੇ ਹੋ